ਗੀਤਾਂ ਸੰਬੰਧੀ ਇਹ ਹੈ ਕਿ ਜਿਵੇਂ ਕਿ ਸਤਿੰਦਰ ਸਰਤਾਜ ਅਤੇ ਕਮਰਵਾਲ ਜੀ ਦੇ ਜਿਹੜੇ ਗੀਤ ਹਨ ਉਹ ਸਾਰੇ ਹੀ ਸੁਣਨ ਯੋਗ ਹਨ ਅਤੇ ਪਸੰਦ ਕੀਤੇ ਜਾਂਦੇ ਹਨ ਉਹਨਾਂ ਤੋਂ ਇਲਾਵਾ ਜਿਹੜਾ ਸਾਨੂੰ ਸੁਣਨ ਦਾ ਸ਼ੌਂਕ ਹੈ ਅਸੀਂ ਕੀਰਤਨ ਨੂੰ ਜ਼ਿਆਦਾ ਪਸੰਦ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਹਰਜਿੰਦ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰਣਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਫਤਿਹਗੜ ਸਾਹਿਬ ਤੋਂ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਹਨ ਭਾਈ ਰਵਿੰਦਰ ਸਿੰਘ ਜੀ ਦਾ ਸ਼ਬਦ ਹੈ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਣ ਇੱਦਾਂ ਦੇ ਜਿਹੜੇ ਸ਼ਬਦ ਨੇ ਉਹ ਬਹੁਤ ਵਧੀਆ ਹਨ ਅਤੇ ਸਾਡੇ ਵੱਲੋਂ ਵਾਰ ਵਾਰ ਇਹਨਾਂ ਨੂੰ ਸੁਣਿਆ ਜਾਂਦਾ ਏ ਇਹਨਾਂ ਦੀ ਜੋ ਸ਼ਬਦ ਗਾਇਨ ਦੀ ਪ੍ਰਕਿਰਿਆ ਹੈ ਜੋ ਇਹਨਾਂ ਦੀ ਚਾਲ ਹੈ ਬਹੁਤ ਠਰ੍ਹੰਮੇ ਵਾਲੀ ਹੁੰਦੀ ਹੈ ਜਿਸ ਕਾਰਨ ਸਾਨੂੰ ਇਹ ਪਸੰਦ ਲ ਆਉਂਦੇ ਹਨ